ਹਰ ਦੇਸ਼ ਪ੍ਰਾਂਤ ਅਤੇ ਸਮਾਜ ਵਿੱਚ ਮੇਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ ਮੇਲੇ ਕਹਿ ਲਉ ਜਾਂ ਤਿਉਹਾਰ ਕਹਿ ਲਉ ਭਾਰਤ ਦੇਸ਼ ਵੀ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਹਰ ਮਹੀਨੇ ਕੋਈ ਨਾ ਕੋਈ ਮੇਲਾ ਮਨਾਇਆ ਜਾਂਦਾ ਹੈ ਇਹਨਾਂ ਮੇਲਿਆਂ ਵਿੱਚ ਆਪਣਾ ਇਤਿਹਾਸਕ ਅਤੇ ਮਿਥਿਹਾਸਿਕ ਪਿਛੋਕੜ ਹੁੰਦਾ ਹੈ ਪੰਜਾਬ ਵਿੱਚ ਬਹੁਤ ਸਾਰੇ ਮੇਲੇ ਮਨਾਏ ਜਾਂਦੇ ਹਨ ਇਹ ਮੇਲੇ ਸਮਾਜ ਵਿੱਚ ਪਿਆਰ ਸਦਭਾਵਨਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਵਧਾਉਂਦੇ ਹਨ ਮੇਲੇ ਜਿੱਥੇ ਮਨਪਰਚਾਵੇ ਦਾ ਸਾਧਨ ਹੁੰਦੇ ਹਨ ਉੱਥੇ ਇਹਨਾਂ ਦੀ ਇਸ ਤੋਂ ਵੱਡੀ ਉਸਾਰੀ ਭੂਮਿਕਾ ਹੁੰਦੀ ਹੈ ਮੇਲਿਆਂ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹਰ ਤਿਉਹਾਰ ਦਾ ਆਪਣਾ ਵਿਲੱਖਣ ਪਿਛੋਕੜ ਹੁੰਦਾ ਹੈ ਇਸ 'ਚ ਇਕੱਠੇ ਹੋ ਕੇ ਲੋਕਾਂ ਨੂੰ ਪਤਾ ਲੱਗਦਾ ਕਿ ਕਿਵੇਂ ਉਹ ਇੱਕ ਵੱਡੇ ਸਮਾਜ ਦੇ ਵਿ ਦੇ ਅੰਗ ਮਾਤਰ ਹਨ ਇਹ ਮੇਲੇ ਇਹ ਤਿਉਹਾਰ ਮਨੋਰੰਜਨ ਦਾ ਬਹੁਤ ਹੀ ਪ੍ਰਮੁੱਖ ਸਾਧਨ ਹੁੰਦੇ ਹਨ ਇਤਿਹਾਸਕ ਸਮਾਗਮ ਸਾਨੂੰ ਸਾਡੇ ਸੱਭਿਆਚਾਰ ਅਤੇ ਇਤਿਹਾਸ ਦੇ ਨਾਲ਼ ਜੋੜਦੇ ਹਨ ਧਾਰਮਿਕ ਦ੍ਰਿਸ਼ਟੀ ਨਾਲ਼ ਜੁੜੇ ਜਿਹੜੇ ਤਿਉਹਾਰ ਹੈ ਪ੍ਰਤੀ ਲੋਕਾਂ ਦੀਆਂ ਵੱਡੀ ਵੱਖਰੀ ਤਰ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਪੀਰਾਂ ਫ਼ਕੀਰਾਂ ਦੀ ਯਾਦ ਵਿੱਚ ਮਨਾਏ ਜਾਂਦੇ ਤਿਉਹਾਰ ਅਤੇ ਖੇਡ ਮੇਲਿਆਂ ਦਾ ਆਪੋ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ ਇੰਝ ਮੇਲੇ ਸਾਡੇ ਸਮਾਜਿਕ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦਾ ਅਹਿਮ ਅੰਗ ਹਨ ਪੰਜਾਬ ਜਿੱਥੇ ਸਖ਼ਤ ਮਿਹਨਤ ਤਾਂ ਪੰਜਾਬੀ ਕਰਦੇ ਹਨ ਉੱਥੇ ਉਹ ਮਨਪਰਚਾਵੇ ਵੱਲੋਂ ਤਿਉਹਾਰਾਂ ਦੇ ਵੀ ਬਹੁਤ ਸ਼ੌਕੀਨ ਹੁੰਦੇ ਹਨ ਪੰਜਾਬ ਵਿੱਚ ਕਈ ਕਿਸਮ ਦੇ ਤਿਉਹਾਰ ਮਨਾਏ ਜਾਂਦੇ ਹਨ ਦੁਸਹਿਰਾ ਦਿਵਾਲੀ ਵਿਸਾਖੀ ਬਸੰਤ ਹੋਲੀ ਇੱਦਾਂ ਹੀ ਕਈ ਤਿਉਹਾਰ ਹਨ ਜੋ ਸਾਡੇ ਭਾਰਤ ਵਿੱਚ ਵੀ ਮਨਾਏ ਜਾਂਦੇ ਹਨ ਪੰਜਾਬ ਵਿੱਚ ਮਨਾਏ ਜਾਂਦੇ ਹਨ ਇਹ ਸਰਬ ਸਾਂਝੇ ਤਿਉਹਾਰ ਹਨ ਜਿਨ੍ਹਾਂ ਨੂੰ ਹਰ ਸ਼ਹਿਰ ਕਸਬੇ ਅਤੇ ਪਿੰਡ ਵਿੱਚ ਮਨਾਇਆ ਜਾਂਦਾ ਹੈ ਪਰ ਇਹਨਾਂ ਤਿਉਹਾਰਾਂ ਵਿੱਚੋਂ ਕਈ ਤਿਉਹਾਰਾਂ ਦੀ ਪ੍ਰਸਿੱਧਤਾ ਕਿਸੇ ਇੱਕ ਸਥਾਨ ਨਾਲ਼ ਜੁੜੀ ਹੁੰਦੀ ਹੈ ਜਿਵੇਂ ਦਿਵਾਲੀ ਅੰਮ੍ਰਿਤਸਰ ਦੀ ਵਧੇਰੇ ਪ੍ਰਸਿੱਧ ਹੈ ਬਸੰਤ ਦਾ ਮੇਲਾ ਵਿਸ਼ੇਸ਼ ਕਰਕੇ ਛੇਹਰਟਾ ਸਾਹਿਬ ਵਿਖੇ ਮਨਾਇਆ ਜਾਂਦਾ ਵਿਸਾਖੀ ਦਾ ਮੇਲਾ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ਼ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ਜਿਹੜਾ ਉਹ ਮਾਘੀ ਮੁਕਤਸਰ ਸਾਹਿਬ ਦੀ ਵਧੇਰੇ ਮਸ਼ਹੂਰ ਹੈ ਅਤੇ ਹੋਲਾ ਮਹੱਲਾ ਆਨੰਦਪੁਰ ਸਾਹਿਬ ਵਿਖੇ ਵੇਖਣ ਯੋਗ ਹੁੰਦਾ ਹੈ ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲੇ ਵਿੱਚ ਪੂਰੀ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਸਰਬ ਸਾਂਝੇ ਤਿਉਹਾਰਾਂ ਵਾਂਗ ਹੀ ਵੱਖ ਵੱਖ ਥਾਵਾਂ 'ਤੇ ਵੱਖਰੇ ਵੱਖਰੇ ਮੇਲੇ ਲੱਗਦੇ ਹਨ ਇਹਨਾਂ ਤਿਉਹਾਰਾਂ ਦਾ ਸੰਬੰਧ ਵਿਸ਼ੇਸ਼ ਇਲਾਕੇ ਨਾਲ਼ ਹੁੰਦਾ ਹੈ ਅਤੇ ਅਸੀਂ ਹੀ ਤਰਨਤਾਰਨ ਵਿੱਚ ਹਰੇਕ ਮੱਸਿਆ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਛਪਾਰ ਦਾ ਇੱਕ ਤਿਉਹਾਰ ਛਪਾਰ ਪਿੰਡ ਵਿੱਚ ਗੁੱਗੇ ਦੀ ਮਾੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਹੀ ਫਤਿਹਗੜ੍ਹ ਸਾਹਿਬ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੇਲਾ ਮਨਾਇਆ ਜਾਂਦਾ ਹੈ ਪੰਜਾਬ ਹੈ ਹੀ ਤਿਉਹਾਰਾਂ ਦਾ ਦੇਸ਼ ਮੇਲਿਆਂ ਦਾ ਦੇਸ਼ ਹੈ